ਹੈਲੋ ਮਨਵੀਰ ਡਰਾਈਵਰ ਬੋਲ ਰਹੇ ਹੋ ਜੀ ਮੈਂ ਤੁਹਾਨੂੰ ਕੱਲ੍ਹ ਟੈਕਸੀ ਬੁੱਕ ਕੀਤੀ ਸੀ ਅਤੇ ਪੈਸੇ ਵੀ ਅਡਵਾਂਸ ਹਾਫ ਦਿੱਤੇ ਸੀ ਆਪਾਂ ਤੁਹਾਨੂੰ ਦੱਸਿਆ ਸੀ ਕੱਲ੍ਹ ਨੂੰ ਆਪਾਂ ਛੇ ਵਜੇ ਸਵੇਰੇ ਪੀ ਜੀ ਆਈ ਜਾਣਾ ਏ ਆ ਮੇਰੇ ਭਰਾ ਦੀ ਥੋੜ੍ਹੀ ਤਬੀਅਤ ਠੀਕ ਨਹੀਂ ਹੈ ਅਤੇ ਇਸ ਲਈ ਤੁਹਾਨੂੰ ਕੀਤਾ ਕਿਹਾ ਸੀ ਕਿ ਛੇ ਵਜੇ ਪਹੁੰਚ ਜਾਇਓ ਪਰ ਹੁਣ ਪੌਣੇ ਛੇ ਹੋ ਚੁੱਕੇ ਹਨ ਤੁਸੀਂ ਹਜੇ ਵੀ ਪਹੁੰਚੇ ਨਹੀਂ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਇਸ ਸਮੇਂ ਕਿੱਥੇ ਪਹੁੰਚ ਚੁੱਕੇ ਓਂ ਮੈਨੂੰ ਆਪਣਾ ਲੌਕੇਸ਼ਨ ਦਿਓ ਕਿੱਥੇ ਇਸ ਟਾਈਮ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦੇਣਾ ਚਾਹੁੰਦਾ ਹਾਂ ਬਲਾਚੌਰ ਆ ਕੇ ਮੇਨ ਚੌਂਕ ਵਿੱਚ ਸੱਜੇ ਹੱਥ ਮੁੜ ਜਾਇਓ ਉਸ ਤੋਂ ਅੱਗੇ ਵਾਡ ਨੰਬਰ ਦੋ ਆਊਗਾ ਉਸ ਦੇ ਨਾਲ਼ ਹੀ ਅੱਗੇ ਇੱਕ ਗੁਰਦੁਆਰਾ ਆਵੇਗਾ ਗੁਰਦੁਆਰੇ ਦੇ ਨਾਲ਼ ਹੀ ਮੇਰਾ ਘਰ ਹੈ ਕਿਰਪਾ ਕਰਕੇ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ ਆਪਾਂ ਛੇ ਵਜੇ ਇੱਥੋ ਤੁਰਨਾ ਏ ਕਿਉਂਕਿ ਹੁਣ ਮੌਸਮ ਵੀ ਜ਼ਿਆਦਾ ਖ਼ਰਾਬ ਹੋ ਰਿਹਾ ਹੈ ਸਰਦੀਆਂ ਦਾ ਸਮਾਂ ਏ ਆ ਅਤੇ ਧੁੰਦ ਹੋ ਰਹੀ ਹੈ ਜ਼ਿਆਦਾ ਸਾਨੂੰ ਜਾਣ ਵਿੱਚ ਦਿੱਕਤ ਹੋ ਸਕਦੀ ਹੈ ਅੱਗੇ ਇੱਕ ਹੋਰ ਮੁੰਡੇ ਨੂੰ ਆਪਾਂ ਉੱਥੋਂ ਚੁੱਕਣਾ ਹੈ ਜਿਹਨੂੰ ਸਾਰੀ ਇੰਨਫੋਮੇਸ਼ਨ ਪਤਾ ਹੈ ਉੱਥੇ ਕਿਸ ਸਾਈਡ ਜਾਣਾ ਆ ਆਪਾਂ ਇਸ ਕਰਕੇ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਹਾਂ ਜਲਦੀ ਤੋਂ ਜਲਦੀ ਪਹੁੰਚੋ ਫਿਰ ਵੀ ਜੇ ਤੁਹਾਨੂੰ ਕੋਈ ਲੱਗ ਰਿਹਾ ਆ ਮੇਰੇ ਨੰਬਰ 'ਤੇ ਦੁਆਰਾ ਕੋਲ ਕਰਕੇ ਮੈਨੂੰ ਪੁੱਛ ਸਕਦੇ ਹੋ ਆਪਾਂ ਜਲਦੀ ਜਾਣਾ ਤਾਂ ਜਲਦੀ ਪਹੁੰਚੋ